ਮਾਈਗਰੇਸ਼ਨ ਤੋਂ ਭਾਵ ਪਰਵਾਸ ਜਿੰਦਗੀ ਵਿੱਚ ਹਰੇਕ ਨੂੰ ਤਬਦੀਲੀ ਚਾਹੀਦੀ ਹੈ ਪੰਛੀ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਆਪਣੀ ਜ਼ਿੰਦਗੀ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਆਪਣਾ ਪਰਿਵਾਸ ਚੇਂਜ ਕਰਦੇ ਹਨ ਹਾਂ ਅਸੀਂ ਕਈ ਵਾਰ ਪ੍ਰਵਾਸੀ ਪੰਛੀ ਦੇਖੇ ਹਨ ਉਹਨਾਂ ਨੂੰ ਦੇਖ ਕੇ ਅਨੁਭਵ ਹੁੰਦਾ ਹੈ ਕਿ ਜ਼ਿੰਦਗੀ ਵਿੱਚ ਬਦਲਾਵ ਹੋਣਾ ਜਰੂਰੀ ਹੈ ਸੰਸਾਰ ਦੇ ਉੱਤਰੀ ਹਿੱਸੇ ਤੋਂ ਭਾਰਤ ਦੇ ਪੱਛਮੀ ਘਾਟ ਦੇ ਅਤੇ ਭਾਰਤ ਦੇ ਦੱਖਣ ਵੱਲ ਨੂੰ ਪੰਛੀ ਆਂਦੇ ਹਨ ਕਈ ਪੰਛੀ ਪੰਜਾਬ ਦੇ ਅੰਮ੍ਰਿਤਸਰ ਵੱਲ ਹਰੀ ਕੇ ਪੱਤਣ ਵੱਲ ਵੀ ਪਹੁੰਚਦੇ ਹਨ ਰਫਸਾਈਬੇਰੀਅਨ ਕਰੇਨ ਬਲੂ ਥਰੋਟ ਗੜਵਾਲੀ ਅਤੇ ਕਈ ਹੋਰ ਪੰਛੀ ਸਾਈਪੇਰੀਆ ਰਸ਼ੀਆ ਗਰੀਨਲੈਂਡ ਤੋਂ ਉੜ ਕੇ ਭਾਰਤ ਵੱਲ ਨੂੰ ਆਉਂਦੇ ਹਨ ਜਦੋਂ ਵੀ ਇਹ ਪੰਛੀ ਆਉਂਦੇ ਹਨ ਤੇ ਇੱਕ ਝੁੰਡ ਵਿੱਚ ਉੜ ਕੇ ਆਉਂਦੇ ਹਨ ਉਹਨਾਂ ਨੂੰ ਅਨੁਭਵ ਹੁੰਦਾ ਹੈ ਕੀ ਇਨਸਾਨ ਨੂੰ ਇਕੱਠ ਵਿੱਚ ਰਹਿਣਾ ਚਾਹੀਦਾ ਹੈ ਇਹ ਸਾਡੀ ਇਕ ਸਮਾਜਿਕ ਜਿੰਮੇਵਾਰੀ ਹੈ ਕਿ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ